ਭਾਰਤੀ ਡਾਸਰਾਂ ਉੱਤੇ ਬੋਲੀਵੁੱਡ ਦਾ ਬਹੁਤ ਜ਼ਿਆਦਾ ਪ੍ਰਭਾਵ ਹੈ ਕਿਉਂਕਿ ਬੋਲੀਵੁੱਡ ਇੱਕ ਅਜਿਹੀ ਸੰਸਥਾ ਬਣ ਚੁੱਕੀ ਹੈ ਜੋ ਗੀਤਾਂ ਅਤੇ ਨਾਚ ਤੋਂ ਜਿਹੜੀ ਹੈ ਆਪਾਂ ਅਲੱਗ ਨਹੀਂ ਕਰ ਸਕਦੇ ਗੀਤ ਅਤੇ ਨਾਚ ਹੀ ਹਰ ਬਾਲੀਵੁੱਡ ਦੀ ਫਿਲਮ ਨੂੰ ਜਿਹੜੇ ਹੈ ਅੱਗੇ ਲੈ ਕੇ ਜਾਂਦੇ ਨੇ ਸੋ ਡਾਂਸਰ ਕੋਸ਼ਿਸ਼ ਕਰਦੇ ਹਨ ਕਿ ਉਹ ਬਾਲੀਵੁੱਡ ਦੇ ਐਕਟਰਾਂ ਵਾਂਗ ਨੱਚ ਸਕਣ ਲੋਕਾਂ ਦੀਆਂ ਨੂੰ ਰੁਝਾਉਣ ਦੀ ਕੋਸ਼ਿਸ਼ ਕਰ ਸਕਣ ਉਹਨਾਂ ਦੇ ਮਨਾਂ ਵਿੱਚ ਉੱਤਰ ਸਕਣ ਅਤੇ ਹੁਣ ਗੱਲ ਕਰੀਏ ਗੀਤਾਂ ਦੀ ਜੋ ਭਾਰਤ ਦੇ ਵਿੱਚ ਹਰ ਕਿਸੇ ਨੂੰ ਪਸੰਦ ਨੇ ਤਾਂ ਬਹੁਤੇ ਪੰਜਾਬੀ ਹੀ ਗੀਤ ਨਹੀਂ ਜਿਹੜੇ ਮਕਬੂਲ ਹੁੰਦੇ ਨੇ ਹਰ ਥਾਂ 'ਤੇ ਵੱਜਦੇ ਨੇ ਕਹਿ ਸਕਦੇ ਹਾਂ ਜਿਸ ਉੱਤੇ ਹਰ ਭਾਰਤ ਦੇ ਹਰ ਲੋਕ ਜਿਹੜੇ ਨੇ ਉਹ ਨੱਚਦੇ ਨੇ ਜਿਵੇਂ ਇੱਕ ਗੀਤ ਸੀਗਾ ਡੀਜੇ ਵਾਲੇ ਬਾਬੂ ਮੇਰਾ ਗਾਣਾ ਚਲਾ ਦੇ ਇਹ ਉਹ ਗੀਤ ਹੈ ਜੋ ਹਰ ਥਾਂ 'ਤੇ ਮਕਬੂਲ ਹੋਇਆ ਪੰਜਾਬੀ ਦਾ ਇੱਕ ਗੀਤ ਹੈ ਮਰਜਾਣੀ ਪਾਉਂਦੀ ਭੰਗੜਾ ਅੰਗਰੇਜ਼ੀ ਬੀਟ 'ਤੇ ਵੀ ਕੋ ਕਾਫੀ ਪਾਪੂਲਰ ਗੀਤ ਏ ਜਿਹੜਾ ਹਲੇ ਤੱਕ ਵੀ ਗਾਇਆ ਵਜਾਇਆ ਜਾਂਦਾ ਹੈ ਇਸ ਤੋਂ ਇਲਾਵਾ ਗਰਮੀ ਗਰਮੀ ਗੀਤ ਜਿਹੜਾ ਹੈ ਇਹ ਵੀ ਕਾਫ਼ੀ ਹਿੱਟ ਰਿਹਾ ਤੂੰ ਨਹੀਂ ਬੋਲਦੀ ਰਕਾਨੇ ਤੂੰ ਨਹੀਂ ਬੋਲਦੀ ਤੇਰੇ 'ਚ ਤੇਰਾ ਯਾਰ ਬੋਲਦਾ ਲਗਭਗ ਇੱਕੀ ਬਾਈ ਸਾਲ ਪੁਰਾਣਾ ਗੀਤ ਏ ਜੋ ਹਲੇ ਤੱਕ ਬੜੇ ਹੀ ਜਿਹੜਾ ਹੈ ਨਾਜਾਂ ਨਾਲ ਹਰ ਜਿਹੜੀ ਡਾਂਸ ਸ਼ੋ ਦਾ ਸ਼ਿੰਗਾਰ ਬਣਦਾ ਹੈ ਇਸ ਤੋਂ ਇਲਾਵਾ ਹੁਣ ਕੁਝ ਹਰਿਆਣਵੀ ਰਾਜਸਥਾਨੀ ਗੀਤ ਵੀ ਬਹੁਤ ਚੱਲ ਰਹੇ ਨੇ ਬਾਬਨ ਗਜ ਕਾ ਦਾਮਨ ਪਹਿਨ ਮਟਕ ਚਾਲੂ ਰੇ ਤੇਰੀ ਆਂਖੋਂ ਕਾ ਯੇ ਕਾਜਲ ਅਤੇ ਇਸ ਤੋਂ ਇਲਾਵਾ ਜਿਹੜੇ ਹੈਗੇ ਨੇ ਭੋਜਪੁਰੀ ਗੀਤਾਂ 'ਤੇ ਵੀ ਜਿਹੜਾ ਨਾਚ ਹੈ ਉਹ ਕੀਤਾ ਜਾਂਦਾ ਹੈ ਸੋ ਬਹੁਤ ਸਾਰੇ ਗੀਤ ਨੇ ਜੋ ਭਾਰਤ ਦੇ ਵਿੱਚ ਪਸੰਦ ਕੀਤੇ ਜਾਂਦੇ ਹਨ ਜਿਹਨਾਂ ਵਿੱਚੋਂ ਕੁਝ ਦਾ ਜ਼ਿਕਰ ਮੈਂ